ਹਾਂ ਵੀ ਕਿੱਦਾਂ ਹੈਲੋ ਹਾਂ ਹਾ ਸਤਿ ਸ਼੍ਰੀ ਅਕਾਲ ਓ ਕਿੰਦਰ ਸਿਹਾਂ ਕੀ ਹਾਲ ਆ ਵਧੀਆ ਵਧੀਆ ਵਧੀਆ ਤੈਨੂੰ ਪਤਾ ਭਰਾ ਆਪਣੇ ਉਹ ਹੋਈ ਸੀ ਮੈਂ ਪੜ੍ਹਦਾ ਸੀਗਾ ਹੁਣੀ ਆਪਣੇ ਪੰਜਾਬ 'ਚ ਨਾ ਉਹ ਗਰੀਨ ਰੈਵੋਲਿਊਸ਼ਨ ਕੀ ਚੀਜ਼ ਸੀਗੀ ਤੂੰ ਪੜ੍ਹਿਆ ਇਹਦੇ ਬਾਰੇ ਸੁਣਿਆ ਤੂੰ ਉਹ ਤੈਨੂੰ ਯਾਦ ਜਦੋਂ ਇੰਡੀਆ ਆਜ਼ਾਦ ਹੋਇਆ ਹੀ ਸੀਗਾ ਅਤੇ ਖਾਣ ਪੀਣ ਨੂੰ ਹੈ ਨਹੀਂ ਸੀ ਇੰਡੀਆ ਕੋਲ ਅਤੇ ਹਾਂ ਇੰਡੀਆ ਆਜ਼ਾਦ ਹੋਇਆ ਹੋਇਆ ਸੀ ਹਾਂ ਹਾਂ ਹਾਂ ਇੰਡੀਆਂ ਕੋਲ ਖਾਣ ਪੀਣ ਨੂੰ ਵੀ ਹੈ ਨਹੀਂ ਸੀਗਾ ਤਾਂ ਫਿਰ ਉਸ ਟਾਈਮ 'ਤੇ ਪਤਾ ਕਿਹਨਾਂ ਨੇ ਕੀ ਸਰਕਾਰਾਂ ਨੇ ਕੀ ਕੀਤਾ ਸੀਗਾ ਇੰਡੀਆ ਵਾਲ ਆਪਣੇ ਪੂਰੇ ਜਿਵੇਂ ਮਤਲਬ ਉਹ ਹਾਈਬ੍ਰਿਡ ਸੀਡ ਲਿਆ ਕੇ ਦਿੱਤੇ ਸੀ ਇਹਨਾਂ ਨੇ ਸਪੈਸ਼ਲ ਕਿ ਇਹ ਬੀਜ ਬੀਜੋ ਤੁਸੀਂ ਇਹਦੇ ਨਾਲ ਫ਼ਸਲ ਵਧੀਆ ਹੋਊਗੀ ਅਤੇ ਭਰਾਵਾ ਉਹ ਚੀਜ਼ ਨਾਲ ਫ਼ਰਕ ਪਿਆ ਕੋਈ ਹੋਰ ਉਹਦੇ ਨਾਲ ਜਿਹੜਾ ਆਪਣਾ ਪੰਜਾਬ ਸੀਗਾ ਉਹ ਪਹੁੰਚ ਗਿਆ ਟੋਪ ਦੇ ਉੱਤੇ ਫ਼ਸਲ ਉਗਾਉਣ 'ਚ ਆਪਣੇ ਪੰਜਾਬ 'ਚ ਸਭ ਤੋਂ ਵਧੀਆ ਫ਼ਸਲ ਸਭ ਤੋਂ ਟੋਪ ਦੀ ਫ਼ਸਲ ਹੁੰਦੀ ਹੁੰਦੀ ਸੀ ਐਗਰੀਕਲਚਰ ਅਤੇ ਖੇਤੀਬਾੜੀ 'ਚ ਪੰਜਾਬ ਦਾ ਨਾਮ ਬੋਲਦਾ ਹੁੰਦਾ ਸੀ ਤੂਤੀ ਬੋਲਦੀ ਹੁੰਦੀ ਸੀ ਪੰਜਾਬ ਦੀ ਕਿ ਹਾਂ ਪੰਜਾਬ ਆ ਹੋ ਰਿਹਾ ਅੱਗੇ ਇੰਨਾ ਫ਼ਰਕ ਪੈ ਗਿਆ ਸੀ ਸਭ ਤੋਂ ਟੋਪ ਸਭ ਤੋਂ ਵੱਧ ਪੰਜਾਬ ਦੀ ਪਰਖਿਆ ਪਿਟਾਨਕ ਜੀ ਡੀ ਪੀ ਸਭ ਕੁਝ ਚੱਕੀ ਗਈ ਸੀ ਹੋਰ ਇੰਨਾ ਵਧੀਆ ਹੋ ਗਿਆ ਸੀਗਾ ਹੋਰ ਇੰਨਾ ਭਰਾਵਾ ਬੜਾ ਫ ਫਾਇਦਾ ਕਰ ਤਾ ਸੀਗਾ ਇਕਦਮ ਮੈਂ ਵੀ ਇਕਦਮ ਪੜ੍ਹ ਰਿਹਾ ਸੀ ਫਿਰ ਮੇਰੇ ਦਿਮਾਗ 'ਚ ਮੈਂ ਵੀ ਇਕਦਮ ਅੱਜ ਦੇਖ ਰਿਹਾ ਸੀਗਾ ਫਿਰ ਮੈਂ ਦੇਖਿਆ ਮੈਂ ਕਿਹਾ ਵੀ ਅੱਛਾ ਆਪਣੇ ਨਾਲ ਅੱਛਾ ਇੰਨਾ ਕੁਛ ਹੋਇਆ ਮਤਲਬ ਮੇਰੇ ਦਿਮਾਗ 'ਚ ਐਵੇਂ ਨਾਲ ਦੀ ਤੇਰੇ ਨਾਲ ਗੱਲ ਕਰਾਂ ਫਿਰ ਮੈਂ ਹੋਰ ਬੜਾ ਹਾਂ ਬੜੀ ਤਕੜੀ ਚੀਜ਼ ਸੀ ਮੈਂ ਤਾਂ ਆਪ ਦੇਖ ਕੇ ਖੁਸ਼ ਹੋ ਗਿਆ ਮੈਂ ਕਿਹਾ ਇੰਨਾ ਇੰਨਾ ਵਿਕਾਸ ਆ ਗਿਆ ਸੀਗਾ ਪੰਜਾਬ ਦਾ ਪੰਜਾਬ ਦਾ ਚਲੋ ਆਪਣਾ ਸ਼ ਫਿਰ ਵੀ ਵਧੀਆ ਹੀ ਰਿਹਾ ਹੋਰ ਆਪਣੇ ਟੈ ਆਪਣਾ ਤਾਂ ਬਹੁਤ ਵਧੀਆ ਰਿਹਾ ਪੰਜਾਬ ਉਹੀ ਜੇ ਇੱਥੇ ਰਹਿ ਕੇ ਕੰਮ ਕਰਨ ਤਾਂ ਕੋਈ ਇਹ ਤਾਂ ਨਹੀਂ ਗਿਆ ਪੰਜਾਬ ਕਿਤੇ ਨਹੀਂ ਜਾਂਦਾ ਹੋਰ ਸਾਰੇ ਹੀ ਬਾਹਰ ਨੂੰ ਭੱਜੇ ਜਾਂਦੇ ਆ ਬਸ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਚਲੋ ਕੋਈ ਨਹੀਂ ਹੋਰ ਪਰ ਐਂ ਆ ਨਾ ਸੁਣ ਕੇ ਮੈਨੂੰ ਬੜਾ ਵਧੀਆ ਲੱਗਿਆ ਇਹਦੇ ਬਾਰੇ ਕਹਿੰਦੇ ਕਿਸਾਨ ਦਾ ਜਦੋਂ ਲਾਏ ਫਿਰ ਬੀਜੇ ਵੀ ਮਤਲਬ ਉੱਥੋਂ ਪੰਜਾਬ ਕਿੱਥੇ ਪਹੁੰਚ ਗਿਆ ਉਹ ਚੀਜ਼ ਬਾਰੇ ਸੁਣ ਕੇ ਬੜਾ ਵਧੀਆ ਲੱਗਦਾ

ਓਕੇ ਵੀਰੇ ਓਕੇ